ਉੱਦਾਂ ਤਾਂ ਹਰੇਕ ਧਰਮ ਦੇ ਲੋਕ ਹੀ ਹਰੇਕ ਤੀਰ ਤਿਉਹਾਰ ਨੂੰ ਮਨਾਉਣਾ ਬਹੁਤ ਪਸੰਦ ਕਰਦੇ ਹਨ ਪਰ ਜੇ ਗੱਲ ਕਰੀਏ ਕਿ ਸਾਰੇ ਇਕੱਠੇ ਰਲ਼ ਕੇ ਕਿਹੜਾ ਤਿਉਹਾਰ ਇਕੱਠਾ ਮਨਾਉਂਦੇ ਹਨ ਤਾਂ ਵਿਸਾਖੀ ਦਾ ਤਿਉਹਾਰ ਮੇਨ ਮੰਨਿਆ ਜਾਂਦਾ ਹੈ ਕਾਰਨ ਇਹ ਹੈ ਕਿ ਹਰੇਕ ਕਿਸਾਨ ਦੇ ਘਰ ਦੇ ਵਿੱਚ ਫ਼ਸਲਾਂ ਆਉਂਦੀਆਂ ਹਨ ਉਹ ਰਲੀਜ਼ਨ ਨਾਲ਼ ਨਹੀਂ ਸੰਬੰਧਿਤ ਹੈ ਕੋਈ ਸਿੱਖ ਵੀ ਹੋ ਸਕਦਾ ਹਿੰਦੂ ਵੀ ਹੋ ਸਕਦਾ ਮੁਸਲਿਮ ਵੀ ਹੋ ਸਕਦਾ ਕੋਈ ਵੀ ਕਿਸਾਨ ਹੋ ਸਕਦਾ ਜਦੋਂ ਫ਼ਸਲਾਂ ਆਉਂਦੀਆਂ ਹਨ ਸਾਰੇ ਖੁਸ਼ ਹੋ ਕੇ ਆਪਣੇ ਆਪਣੇ ਰੱਬ ਨੂੰ ਆਪਣੇ ਹਿਸਾਬ ਨਾਲ਼ ਉਹ ਮਨਾਉਂਦੇ ਹਨ ਅਤੇ ਪੂਜਾ ਕਰਦੇ ਹਨ ਅਤੇ ਖੁਸ਼ਹਾਲ ਰਹਿੰਦੇ ਹਨ